ਆਪਣੇ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਬਾਰੇ ਲੋਕਾਂ ਦੀ ਇਹ ਰਾਏ ਹੈ ਕਿ ਜੇਕਰ ਲੋਕ ਖੇਡਾਂ ਖੇਡਦੇ ਹਨ ਤਾਂ ਉਹ ਇੱਕ ਨਸ਼ੇ ਤੋਂ ਦੂਰ ਰਹਿਣ ਦੇ ਬਹੁਤ ਹੀ ਵਧੀਆ ਐਗਜ਼ਾਂਪਲ ਹੋਵੇਗੀ ਕਿਉਂਕਿ ਜਿਹੜਾ ਬੰਦਾ ਇੱਕ ਗੇਮ ਖੇਡਦਾ ਹੈ ਉਹ ਨਸ਼ੇ ਤੋਂ ਦੂਰ ਹੀ ਰਹਿੰਦਾ ਹੈ ਕਿਉਂਕਿ ਨਸ਼ੇ ਵਾਲ਼ਾ ਬੰਦਾ ਗੇਮ ਵਾਲ਼ੇ ਪਾਸੇ ਨਹੀਂ ਜਾ ਸਕਦਾ ਗੇਮ ਵਾਲ਼ੇ ਬੰਦੇ ਨੂੰ ਗੇਮ 'ਤੇ ਹੀ ਧਿਆਨ ਦੇਣਾ ਪਵੇਗਾ ਅਤੇ ਆਪਣੀ ਸਿਹਤ ਵੱਲ ਹੀ ਧਿਆਨ ਦੇਣਾ ਪਵੇਗਾ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਮੇਰੇ ਹਿਸਾਬ ਨਾਲ਼ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਇੱਕ ਨਾ ਇੱਕ ਗੇਮ ਰੱਖਣੀ ਹੀ ਚਾਹੀਦੀ ਹੈ ਜੋ ਕਿ ਉਹ ਹਰ ਰੋਜ਼ ਖੇਡ ਸਕਣ ਅਤੇ ਇਸਨੂੰ ਸਮਾਂ ਜ਼ਰੂਰ ਦੇਣ ਕਿਉਂਕਿ ਗੇਮ ਖੇਡਣ ਨਾਲ਼ ਤੁਹਾਡੇ ਸਰੀਰਕ ਪੱਖੋਂ ਇੱਕ ਐਨਰਜ਼ੀ ਲੈਵਲ ਹੈ ਉਹ ਬਹੁਤ ਹੀ ਉੱਚ ਦਰਜੇ ਦਾ ਬਣ ਜਾਂਦਾ ਹੈ ਜਿਸ ਨਾਲ਼ ਤੁਸੀਂ ਆਪਣੇ ਰੋਜ਼ਗਾਰ